ਚਿੱਤਰ ਬਣਾਉਣ ਲਈ ਕਈ ਤਰ੍ਹਾਂ ਦੇ ਕਲਰ ਆਉਂਦੇ ਹਨ ਜਿਵੇਂ ਬਰੱਸ਼ਾਂ ਵਾਲਾ ਕਲਰ ਸਕੈੱਚ ਕਲਰ ਜਾਂ ਪੈਂਟਿੰਗ ਕਲਰ ਕੁਝ ਇਹੋ ਜਿਹੇ ਕਲਰ ਵੀ ਹਨ ਜੋ ਕਿ ਪਿਚਰ ਨੂੰ ਬਹੁਤ ਹੀ ਵਧੀਆ ਚਿੱਤਰ ਦਰਸਾਉਂਦੇ ਹਨ ਚਿੱਤਰਕਾਰੀ ਵਿੱਚ ਸਭ ਤੋਂ ਪਹਿਲਾਂ ਬੰਦੇ ਨੂੰ ਚਿੱਤਰਕਾਰ ਦੀ ਨੌਲੇਜ ਹੋਣੀ ਚਾਹੀਦੀ ਹੈ ਕੋਈ ਵੀ ਚਿੱਤਰ ਬਣਾਉਣਾ ਹੈ ਤਾਂ ਸਭ ਤੋਂ ਪਹਿਲਾਂ ਉਸਨੂੰ ਸਿੱਖਣਾ ਬਹੁਤ ਜ਼ਰੂਰੀ ਹੈ ਆਪਾਂ ਨੂੰ ਚਿੱਤਰਕਾਰੀ ਬਿਹਤਰ ਬਣਾਉਣ ਲਈ ਆਪਾਂ ਕਲਰਾਂ ਦਾ ਯੂਜ਼ ਕਰਦੇ ਹਾਂ ਜਿਨ੍ਹਾਂ ਨੂੰ ਪੇਂਟਿੰਗ ਕਲਰ ਕਿਹਾ ਜਾਂਦਾ ਹੈ ਉਹਨਾਂ ਪੇਂਟਿੰਗ ਕਲਰਾਂ ਨਾਲ ਚਿੱਤਰ ਬਹੁਤ ਹੀ ਜ਼ਿਆਦਾ ਖੂਬਸੂਰਤ ਬਣਦਾ ਹੈ ਸਭ ਤੋਂ ਪਹਿਲਾਂ ਇੱਕ ਸਾਫ ਪੇਜ ਲਉ ਉਸਦੇ ਉੱਪਰ ਚਿੱਤਰ ਦਾ ਆਕਾਰ ਬਣਾਉ ਆਕਾਰ ਬਣਾਉਣ ਤੋਂ ਬਾਅਦ ਇੱਕ ਬਲੈਕ ਕਲਰ ਦਾ ਪੈੱਨ ਲਉ ਉਸਦੇ ਉੱਪਰ ਮਾਰਕ ਕਰੋ ਅਤੇ ਫਿਰ ਉਸ ਵਿੱਚ ਰੰਗ ਭਰ ਕੇ ਉਸਨੂੰ ਤਿਆਰ ਕਰ ਦਿਉ